ਭਾਰਤ 'ਚ ਡਾਂਸਰਾਂ ਅਤੇ ਬੋਲੀਵੁੱਡ ਦਾ ਬਹੁਤ ਪ੍ਰਭਾਵ ਹੈ ਬਾਲੀਵੁੱਡ ਦੇ ਸਾਰੀ ਫਿਲਮਾਂ 'ਚ ਗਾਣੇ ਹੁੰਦੇ ਹਨ ਇਹਨਾਂ ਗਾਣਿਆਂ ਵਿੱਚ ਡਾਂਸਰਾਂ ਦਾ ਵੀ ਸਥਾਨ ਹੁੰਦਾ ਹੈ ਕਈ ਬਾਲੀਵੁੱਡ ਫਿਲਮਾਂ ਤਾਂ ਮਨੁੱਖੀ ਜੀਵਨ ਨਾਲ ਸੰਬੰਧਿਤ ਹੁੰਦੀ ਹੈ ਬਾਲੀਵੁੱਡ ਦੇ ਬਹੁਤ ਸਾਰੇ ਗੀਤ ਭਾਰਤ ਵਿੱਚ ਹਰ ਇੱਕ ਨੂੰ ਪਸੰਦ ਆਉਂਦੇ ਹਨ ਇਨ੍ਹਾਂ ਵਿੱਚ ਦੇਸ਼ ਭਗਤੀ ਅਤੇ ਹੌਂਸਲੇ ਵਾਲੇ ਗੀਤ ਵੀ ਹੁੰਦੇ ਹਨ ਜੋ ਮਨੁੱਖ ਨੂੰ ਬਹੁਤ ਕੁਛ ਸਿਖਾਉਂਦੇ ਹਨ